ਕੀ ਤੁਸੀਂ ਗਲੀਲੀਓ ਬਾਰੇ ਜਾਣਦੇ ਹੋ ਜਿਸ ਨੇ ਪਹਿਲੀ ਵਾਰ ਬਾਈਬਲ ਦੇ ਉਲਟ ਦੱਸਿਆ ਸੀ ਕੀ ਧਰਤੀ ਸੂਰਜ ਦੁਆਲੇ ਨਹੀਂ ਸੂਰਜ ਦੁਆਲੇ ਘੁੰਮਦੀ ਹੈ ਸੂਰਜ ਧਰਤੀ ਦੁਆਲੇ ਨਹੀਂ ਘੁੰਮਦਾ ਧਰਤੀ ਕੇਂਦਰ 'ਤੇ ਨਹੀਂ ਹੈ ਜਦੋਂ ਕਿ ਸੂਰਜ ਕੇਂਦਰ ਵਿੱਚ ਹੈ ਤਾਂ ਉਸਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ ਕੋਈ ਵੀ ਸੱਚ ਸੁਣਨ ਨੂੰ ਤਿਆਰ ਨਹੀਂ ਸੀ ਪਰ ਉਹ ਆਪਣੇ ਸੱਚ ਉੱਤੇ ਅੜਿਗ ਰਿਹਾ ਉਸਨੇ ਦੱਸਿਆ ਕਿ ਸਾਡੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਸੂਰਜ ਮੰਡਲ ਵਿੱਚ ਸੂਰਜ ਵਿਚਾਲੇ ਹੈ ਅਤੇ ਨੌਂ ਗ੍ਰਹਿ ਇਸਦੇ ਆਲੇ ਦੁਆਲੇ ਘੁੰਮਦੇ ਹਨ ਜੋਤਿਸ਼ ਦੇ ਵਿੱਚ ਮੇਰਾ ਪੂਰਾ ਵਿਸ਼ਵਾਸ ਹੈ ਕਿਉਂਕਿ ਗ੍ਰਹਿਆਂ ਦੀ ਸਥਿਤੀ ਦੇ ਅਨੁਸਾਰ ਬਹੁਤ ਸਾਰੇ ਵਿਅਕਤੀਆਂ ਦਾ ਜੀਵਨ ਵਿਸ਼ਲੇਸ਼ਣ ਮੇਰੇ ਦੁਆਰਾ ਨਿੱਜੀ ਪੱਧਰ 'ਤੇ ਕੀਤਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਜਨਮ ਸਮੇਂ ਦੀ ਤਰੀਕ ਤੁਹਾਡੀ ਜੀਵਨ ਦੇ ਜੀ ਪੀ ਐਸ ਵਾਂਗ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਕਠਿਨਾਈਆਂ ਬਾਰੇ ਜਾਣਨਾ ਚਾਹੁੰਨੇ ਹੋ ਤਾਂ ਗ੍ਰਹਿ ਦੀ ਸਥਿਤੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਜਾਣ ਕੇ ਤੁਸੀਂ ਆਉਣ ਵਾਲੀਆਂ ਮੁਸੀਬਤਾਂ ਬਾਰੇ ਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਹਨਾਂ ਘਟਨਾਵਾਂ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਪਰੰਤੂ ਥੋੜ੍ਹਾ ਜਿਹਾ ਸਾਵਧਾਨ ਰਹਿ ਕੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ